ਵਿਗਿਆਨ ਅਤੇ ਟੈਕਨੋਲੋਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਜਿਵੇਂ ਸਿਹਤ ਸੰਭਾਲ ਲਈ ਸਾਨੂੰ ਜਿੰਮਾਂ ਦਿੱਤੀਆਂ ਪਰ ਅੱਜ ਤੋਂ ਪਹਿਲਾਂ ਆਪਣੇ ਪੁਰਾਣੇ ਜ਼ਮਾਨੇ ਦੇ ਵਿੱਚ ਕੋਈ ਭਲਵਾਨੀ ਭਲਵਾਨੀ ਕਰਦਾ ਸੀ ਦੇਸੀ ਜਿੰਮਾਂ ਵਰਤੀਆਂ ਜਾਂਦੀਆਂ ਦੇਸੀ ਮਤਲਬ ਜਿੱਦਾਂ ਲੋਹਾ ਲੋਹੇ ਨੂੰ ਪਿੰਗਲਾ ਕੇ ਕੁਛ ਇੱਧਰਲੇ ਪਾਸੇ ਭਾਰ ਪਾ ਲਿਆ ਕੁਝ ਇੱਧਰਲੇ ਪਾਸੇ ਭਾਰ ਪਾ ਲਿਆ ਆਪਣੇ ਸਰੀਰ ਦਾ ਜਿੱਦਾਂ ਜੇ ਬਾਹਵਾਂ ਦੀ ਐਕਸਰਸਾਇਜ਼ ਕਰਨੀ ਹੈ ਤਾਂ ਬਾਹਵਾਂ ਦੀ ਹੁੰਦੀ ਸੀ ਜੇ ਲੱਤਾਂ ਦੀ ਕਰਨੀ ਆ ਤਾਂ ਡੰਡ ਮਾਰਨੇ ਪਰ ਇਸ ਦੇ ਉਲਟ ਵਿਗਿਆਨ ਨੇ ਅੱਜ ਸਾਨੂੰ ਟੈਕਨੋਲੋਜੀ ਜਿੰਮ ਜਿੰਮ ਦਿੱਤੇ ਹਨ ਜਿੰਮਾਂ ਵਿੱਚ ਜੇ ਤੁਸੀਂ ਇਕੱਲੀਆਂ ਬਾਹਾਂ ਦੀ ਐਕਸਰਸਾਈਜ਼ ਕਰਨੀਆਂ ਹੈ ਤਾਂ ਬਾਹਾਂ ਦੀ ਹੀ ਕਰ ਸਕਦੇ ਹਾਂ ਤਾਂ ਜੇ ਲੱਤਾਂ ਦੀਆਂ ਕਰਨੀ ਹਾਂ ਤਾਂ ਲੱਤਾਂ ਦੀ ਹੀ ਕਰ ਸਕਦੇ ਹਾਂ ਜੋ ਚੀਜ਼ ਉਸ ਟਾਇਮ ਭਲਵਾਨ ਇੱਕ ਸਾਲ ਵਿੱਚ ਕਰਦੇ ਸੀ ਅੱਜ ਤੁਸੀਂ ਤਿੰਨ ਮਹੀਨੇ ਵਿੱਚ ਉਸ ਨੂੰ ਕਵਰ ਕਰ ਲੈਂਦੇ ਹਨ ਹੁਣ ਇਹਦੇ ਨਾਲ ਹੀ ਤੁਸੀਂ ਲਾ ਲਓ ਪਿਛਲੇ ਤੁਸੀਂ ਦੋ ਦਹਾਕੇ ਪਹਿਲਾਂ ਦੇਖਿਆ ਹੋਊਂਗਾ ਪੂਰੇ ਵਰਲਡ ਵਿੱਚ ਹੀ ਕਰੋਨਾ ਆਇਆ ਸੀ ਕਰੋਨਾ ਵਿੱਚ ਵੀ ਬਹੁਤ ਵਿਗਿਆਨ ਨੇ ਸਾਨੂੰ ਦਿੱਤਾ ਉਹ ਇੱਦਾਂ ਲਾ ਲਓ ਤੁਸੀਂ ਅਸੀਂ ਪਿਛਲੇ ਜ਼ਮਾਨੇ ਵਿੱਚ ਜਾਂਦੇ ਹੁੰਦੇ ਸੀ ਹੌਸਪੀਟਲ ਜਾਂਦੇ ਸੀ ਟੀਕਾ ਲਵਾ ਲਿਆ ਜੀ ਡਾਕਟਰ ਨੇ ਸਾਨੂੰ ਪਰਚੀ ਦੇ ਤੀ ਪਰਚੀ ਅਸੀਂ ਸਾਂਭ ਸਾਂਭ ਰੱਖੀ ਜਾਣੀ ਜਾਂ ਕਿਤੇ ਮਿਸ ਗੁੰਮ ਗਈ ਜਾਂ ਕੁਛ ਹੋ ਗਿਆ ਪਰ ਵਿਗਿਆਨ ਨੇ ਸਾਨੂੰ ਹੁਣ ਐਪਸ ਦਿੱਤੀਆਂ ਨਵੀਆਂ ਕੋਰੋਨਾ 'ਚ ਤੁਸੀਂ ਦੇਖਿਆ ਹੋਊਂਗਾ ਆਪਣਾ ਇਕ ਟੀਕਾ ਲੱਗਿਆ ਸਾਨੂੰ ਨਾਲ ਹੀ ਮੈਸੇਜ ਆਜੇ ਕਰਦਾ ਸੀ ਵੀ ਤੁਹਾਡਾ ਅਗਲਾ ਟੀਕਾ ਤੁਹਾਡਾ ਦੋ ਮਹੀਨੇ ਬਾਅਦ ਲੱਗਣਾ ਹੈ ਤਾਂ ਪਰ ਇਸ ਦੇ ਨਾਲ ਹੀ ਹੁਣ ਤੁਸੀਂ ਕੋਈ ਸਰਕਾਰੀ ਅਦਾਰੇ ਵਿੱਚ ਜਾਂਦੇ ਸੀ ਉਹ ਪਹਿਲਾਂ ਇਹੀ ਪੁੱਛਦੇ ਸੀ ਹਾਂਜੀ ਤੁਹਾਡਾ ਟੀਕਾ ਲੱਗਿਆ ਹੋਇਆ ਹੈ ਅਸੀਂ ਆਪਣਾ ਫੋਨ ਖੋਲ੍ਹਦੇ ਸੀ ਐਪ ਖੋਲ੍ਹਦੇ ਸੀ ਡੇਟ ਦਿਖਾਉਂਦੇ ਇੰਨੀ ਤਰੀਕ ਨੂੰ ਸਾਡਾ ਟੀਕਾ ਲੱਗਿਆ ਦੂਜਾ ਟੀਕਾ ਸਾਡਾ ਦੋ ਮਹੀਨੇ ਬਾਅਦ ਲੱਗਣਾ ਹੈ ਸਾਨੂੰ ਆਪਣੇ ਕੰਮ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਸਾਨੂੰ ਅੰਦਰ ਜਾ ਕੇ ਅਸੀਂ ਅਰਾਮ ਨਾਲ ਆਪਣਾ ਕੰਮ ਕਰਵਾ ਸਕਦੇ ਸੀ ਜਾਂ ਅਸੀਂ ਹੁਣ ਟਰੈਵਲ ਕਰਨਾ ਕਿਤੇ ਅਸੀਂ ਜਾਂ ਗੁਰਦੁਆਰੇ ਦੇ ਦਰਸ਼ਨ ਹੀ ਕਰਨ ਜਾਣੇ ਜਾਂ ਅਸੀਂ ਦਿੱਲੀ ਤੱਕ ਹੀ ਜਾਣਾ ਤਾਂ ਫਿਰ ਰੇਲਵੇ ਵਾਲੇ ਵੀ ਪਹਿਲਾਂ ਸਾਡਾ ਦੇਖੇ ਕਰਦੇ ਸੀ ਵੀ ਹਾਂਜੀ ਭਾਈ ਤੁਹਾਡਾ ਟੀਕਾ ਲੱਗਿਆ ਹੋਇਆ ਹੈ ਟੀਕਾ ਲੱਗਿਆ ਹੋਇਆ ਹੈ ਤਾਂ ਅਸੀਂ ਆਪਣੀ ਐਪ ਖੋਲਦੇ ਸੀ ਅਤੇ ਅਗਲੇ ਨੂੰ ਦਿਖਾ ਦਿੰਦੇ ਸੀ ਤਾਂ ਸਾਨੂੰ ਇੱਡੀ ਕੋਈ ਦਿੱਕਤ ਨਹੀਂ ਆਉਂਦੀ ਸੀ ਇਹ ਸਾਨੂੰ ਵਿਗਿਆਨ ਨੇ ਬਹੁਤ ਜ਼ਿਆਦਾ ਤਰੱਕੀ ਲਾ ਲਓ ਜਾਂ ਟੈਕਨੋਲਜੀ ਇੰਨੀ ਵਧੀਆ ਦੇ ਤੀ ਬਈ ਜਿਹੜਾ ਕੰਮ ਸਾਡਾ ਦੋ ਘੰਟੇ ਵਿਚ ਹੁੰਦਾ ਸੀ ਉਹ ਸਾਡਾ ਪੰਦਰਾਂ ਜਾਂ ਵੀਹ ਮਿੰਟ ਜਾਂ ਅੱਧੇ ਘੰਟੇ ਵਿੱਚ ਹੋਣ ਲੱਗ ਪਿਆ